ਹਾਂਜੀ ਸਰ ਹਾਂਜੀ ਸਰ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਅੱਛਾ ਅੱਛਾ ਠੀਕ ਆ ਸਰ ਉਹ ਨਾ ਤੁਸੀਂ ਜਿਹੜਾ ਬਟਨ ਦਰਵਾਜੇ ਦੇ ਕੋਲ ਨਾ ਤੁਸੀਂ ਉਹ ਨਾ ਯੂਜ ਕਰੋ ਹਾਂਜੀ ਉਹਦੇ ਨਾਲ ਨਾ ਮਤਲਬ ਕਈ ਵਾਰੀ ਉਹ ਅਟੈਚ ਐ ਨਾ ਬਟਨ ਕਈ ਵਾਰੀ ਹੋ ਜਾਂਦਾ ਤਾਂ ਉਹ ਕਈ ਵਾਰ ਸਪਾਰਕਿੰਗ ਦਾ ਮਤਲਬ ਉਹ ਕਈ ਵਾਰ ਹੋ ਜਾਂਦਾ ਉਹ ਠੀਕ ਕਰਾਉਣ ਵਾਲਾ ਤੇ ਉਹ ਥੋੜੀ ਦੇਰ ਦੇ ਵਿੱਚ ਬਿਜਲੀ ਵਾਲਾ ਆ ਰਿਹਾ ਤੇ ਉਹ ਆਪਾਂ ਠੀਕ ਕਰਾ ਲਾਂਗੇ ਤੁਸੀਂ ਨਾਲ ਵਾਲਾ ਜਿਹੜਾ ਟੀਵੀ ਦੇ ਨਾਲ ਵਾਲਾ ਬਟਨ ਹੈ ਨਾ ਤੁਸੀਂ ਉਹ ਚਲਾਓ ਤੇ ਉਸਦੇ ਨਾਲ ਵੀ ਹਾਂਜੀ ਉਹ ਪੱਖੇ ਵਾਲਾ ਅਲੱਗ ਐ ਤੇ ਟੀਵੀ ਵਾਲਾ ਅਲੱਗ ਐ ਤੁਸੀਂ ਟੀਵੀ ਵਾਲਾ ਇੱਕ ਵਾਰ ਬਿਲਕੁਲ ਨਹੀਂ ਚਲਾਣਾ ਟੀਵੀ ਚਲਾਣਾ ਤੁਸੀਂ ਯਾ ਤੁਸੀਂ ਐ ਕਰੋ ਹਾਂਜੀ ਤੁਸੀਂ ਕਰੋ ਜਿਹੜਾ ਤੁਹਾਡੇ ਬੈਕ ਸਾਈਡ ਜਿਹੜਾ ਬਟਨ ਹੈ ਨਾ ਤੁਸੀਂ ਉਹ ਚਲਾਓ ਉਹਦੇ ਨਾਲ ਪੱਖਾ ਪਹਿਲਾਂ ਚੱਲ ਜਾਏਗਾ ਠੀਕ ਏ ਫਿਰ ਟੀਵੀ ਦੇ ਨਾਲ ਥੱਲੇ ਥੋੜਾ ਡਰੋ ਦੇ ਕੋਲ ਵੇਖੋ ਵਾਈਟ ਕਲਰ ਦੇ ਵਿੱਚ ਉੱਥੇ ਸਾਡੇ ਬਟਨ ਬਲੈਕ ਕਲਰ ਦਾ ਹਾਂਜੀ ਹਾਂਜੀ ਉਹ ਟੀਵੀ ਦਾ ਆ ਉਹ ਟੀਵੀ ਦਾ ਜੀ ਤੇ ਉਹ ਤੁਸੀਂ ਓਨ ਕਰੋ ਹਾਂਜੀ ਉਹ ਤੁਸੀਂ ਹਾਂਜੀ ਤੁਹਾਡੀ ਪ੍ਰੋਬਲਮ ਸੋਲਵ ਹੋਗੀ ਹੋਰ ਕੋਈ ਦਿੱਕਤ ਤੁਹਾਨੂੰ ਕੋਈ ਪਤਾ ਨਹੀਂ ਆ ਰਹੀ ਮੈਂ ਕਿਥੋਂ ਕਰ ਇਥੋਂ ਦੀ ਹਾਂਜੀ ਹਾਂਜੀ ਬੋਲੋ ਖੁਸ਼ੀ ਹਾਂਜੀ ਸਰ ਉਹ ਹੈ ਨਾ ਵਿੱਚ ਅੱਜ ਲੈਟ ਹੈ ਨੀ ਉਹ ਲਾਈਟ ਕਰਕੇ ਮਤਲਬ ਜਿਵੇਂ ਜਨਰੇਟਰ ਚੱਲ ਰਿਹਾ ਤਾਂ ਜਨਰੇਟਰ ਕਰਕੇ ਥੋੜੀ ਜਿਹੀ ਨਾ ਜਿਵੇਂ ਜਨਰੇਟਰ ਦੀ ਕੇਵਰ ਤੇਲ ਹਵਾ ਲੈ ਜਾਂਦਾ ਉਹ ਤਾਂ ਕਰਕੇ ਥੋੜੀ ਜਿਹੀ ਦਿੱਕਤ ਆ ਰਹੀ ਏ ਬਾਕੀ ਇਹੋ ਜਿਹੀ ਸਾਡੇ ਹੋਟਲ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਗੀ ਉਹ ਤੁਹਾਡੀ ਥੋੜੀ ਦੇਰ 'ਚ ਹੁਣੇ ਲਾਈਟ ਆ ਜਾਂਦੀ ਲਾਈਟ ਕਰਕੇ ਤੁਹਾਡੀ ਸਾਰੀ ਪ੍ਰੋਬਲਮ ਸੋਲਵ ਹੋ ਜਾਏਗੀ ਤੇ ਬਾਕੀ ਤੁਸੀਂ ਹੋਰ ਤੁਹਾਨੂੰ ਕੋਈ ਦਿੱਕਤ ਆ ਰਹੀ ਹੋਵੇ ਲਾਈਟ ਬਾਰੇ ਹਾਂਜੀ ਕੋਈ ਪ੍ਰੈਸ ਬਾਰੇ ਜਾਂ ਕੋਈ ਹੋਰ ਦਿੱਕਤ ਆ ਰਹੀ ਹੋਵੇ ਕੋਈ ਹਾਂਜੀ ਗਜਰ ਵਗੈਰਾ ਵਗੈਰਾ ਵੀ ਥੋੜਾ ਚੈੱਕ ਕਰਕੇ ਤੁਸੀਂ ਦੇਖ ਲਓ ਤੁਸੀਂ ਮੈਨੂੰ ਇੱਕ ਵਾਰੀ ਆ ਜੀ ਹਾਂਜੀ ਤੁਸੀਂ ਇੱਕ ਵਾਰੀ ਬਟਨ ਆਨ ਕਰਕੇ ਦੇਖ ਲਓ ਹਾਂਜੀ ਲਾਈਟ ਬਾਰੇ ਮੈਨੂੰ ਸਾਰਾ ਦੱਸ ਦੋ ਹਾਂਜੀ ਹਾਂਜੀ ਹਾਂਜੀ ਠੀਕ ਹੋ ਬਟਨ ਠੀਕ ਏ ਗੀਜਰ ਦਾ ਠੀਕ ਠੀਕ ਓਕੇ ਠੀਕ ਐ ਸਰ ਠੀਕ ਐ ਸਰ